ਪੰਜਾਬੀਆਂ ਦਾ ਭੰਗੜਾ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ ਆਪਣੇ ਭੰਗੜੇ ਕਰਕੇ ਹੀ ਪੰਜਾਬੀਆਂ ਨੇ ਪੂਰੀ ਦੁਨੀਆਂ ਵਿੱਚ ਆਪਣੀ ਧਾਕ ਜਮਾਈ ਹੈ ਪੰਜਾਬੀ ਭੰਗੜੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੋ ਚੁੱਕੇ ਹਨ ਪੰਜਾਬੀ ਭੰਗੜਾ ਪਾਉਣ ਲਈ ਜਿਹੜੀ ਫੋਕ ਡਰੈਸ ਪਾਉਂਦੇ ਹਨ ਉਸ ਡਰੈਸ ਦੇ ਵਿੱਚ ਉਹ ਤੁਰਲੇ ਵਾਲੀਆਂ ਪੱਗਾਂ ਬੰਨਦੇ ਹਨ ਜੋ ਕਿ ਗੂੜ੍ਹੇ ਰੰਗਾਂ ਵਾਲੀਆਂ ਜ਼ਿਆਦਾਤਰ ਪਾਈਆਂ ਜਾਂਦੀਆਂ ਹਨ ਇਸ ਭੰਗੜਾ ਪਾਉਣ ਲਈ ਉਹ ਲੰਮੇ ਕੁੜਤੇ ਪਾਉਂਦੇ ਹਨ ਖੁੱਲ੍ਹੇ ਚਾਦਰੇ ਬੰਨ੍ਹਦੇ ਹਨ ਲੱਕ ਅਤੇ ਕਮਰਬੰਦ ਬੰਨ੍ਹਿਆ ਜਾਂਦਾ ਹੈ ਗਲ ਵਿੱਚ ਕੈਂਠੇ ਪਏ ਜਾਂਦੇ ਹਨ ਅਤੇ ਇਹ ਭੰਗੜਾ ਬਹੁਤ ਹੀ ਜੋਸ਼ ਨਾਲ ਪਾਇਆ ਜਾਂਦਾ ਹੈ ਜੋ ਕਿ ਪੰਜਾਬੀਆਂ ਦੇ ਜੋਸ਼ ਨੂੰ ਦਰਸਾਉਂਦਾ ਹੈ ਆਪਣੀ ਖੁਸ਼ੀ ਬਤੀਤ ਕਰਨ ਲਈ ਪੰਜਾਬੀ ਭੰਗੜੇ ਨੂੰ ਹੀ ਵਰਤ ਤਰਜੀਹ ਦਿੰਦੇ ਹਨ ਇਹ ਡਰੈਸ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਜਿਸ ਵੀ ਕਲਾਕਾਰ ਨੇ ਭੰਗੜਾ ਪਾਉਣਾ ਹੋਵੇ ਉਹ ਸਭ ਤੋਂ ਪਹਿਲਾਂ ਭੰਗੜੇ ਦੀ ਡਰੈਸ ਦੀ ਡਿਮਾਂਡ ਕਰਦਾ ਹੈ ਭੰਗੜੇ ਦੀ ਡਰੈਸ ਪਾ ਕੇ ਪਾਇਆ ਗਿਆ ਭੰਗੜਾ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਜੋ ਵੀ ਭੰਗੜਾ ਪਾਉਣ ਵਾਲਾ ਅਪ ਅਚ ਗੂੜ੍ਹੀ ਪੱਗ ਬੰਨ੍ਹ ਕੇ ਅਤੇ ਚਾਦਰਾ ਬੰਨ੍ਹ ਕੇ ਅਤੇ ਤਿੱਲੇਦਾਰ ਜੁੱਤੀ ਪਾ ਕੇ ਭੰਗੜਾ ਪਾਉਂਦਾ ਹੈ ਉਹ ਦੂਰੋਂ ਹੀ ਦੇਖਣ ਵਾਲੇ ਦਾ ਮਨ ਮੋਹ ਲੈਂਦਾ ਹੈ ਇਸ ਵਿੱਚ ਗੂੜ੍ਹੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਦੇਖਣ ਵਾਲੇ ਦਾ ਅਤੇ ਭੰਗੜਾ ਪਾਉਣ ਵਾਲੇ ਦਾ ਜੋਸ਼ ਦੁੱਗਣਾ ਕਰ ਦਿੰਦੀ ਹੈ ਪੰਜਾਬੀਆਂ ਦਾ ਭੰਗੜੇ ਨੇ ਪੂਰੀ ਦੁਨੀਆਂ ਵਿੱਚ ਨਾਮ ਖੱਟਿਆ ਹੈ ਅਤੇ ਪੂਰੇ ਵਰਲਡ ਦੇ ਵਿੱਚ ਉਹ ਫੇਮਸ ਹੈ ਪੰਜਾਬੀ ਭੰਗੜਾ ਪਾਉਣ ਲਈ ਜੋ ਡਰੈਸ ਵਰਤਦੇ ਹਨ ਉਹ ਜ਼ਿਆਦਾਤਰ ਸੂਤੀ ਕੱਪੜਾ ਵਰਤਿਆ ਜਾਂਦਾ ਹੈ ਅਤੇ ਪੱਗਾਂ ਦੇ ਰੰਗ ਅਤੇ ਸੂਟ ਦੇ ਰੰਗ ਗੂੜ੍ਹੇ ਵਰਤੇ ਜਾਂਦੇ ਹਨ ਪੰਜਾਬੀ ਭੰਗੜਾ ਪੂਰੇ ਜੋਸ਼ ਨਾਲ ਪਾਇਆ ਜਾਂਦਾ ਹੈ ਅਤੇ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਇਹ ਅ ਡਰੈਸ ਇੰਨੀ ਸੋਹਣੀ ਹੁੰਦੀ ਹੈ ਕਿ ਨਾ ਚਾਹੁੰਦੇ ਹੋਏ ਵੀ ਹਰੇਕ ਦਾ ਧਿਆਨ ਇਸ ਵੱਲ ਜਾਂਦਾ ਹੈ ਅਤੇ ਜਦੋਂ ਦਰਸ਼ਕ ਜ਼ਿਆਦਾ ਦੇਖਦੇ ਹਨ ਹਰ ਇੱਕ ਦਾ ਧਿਆਨ ਜਦੋਂ ਆਪਣੇ ਵੱਲ ਹੁੰਦਾ ਹੈ ਤਾਂ ਪਾਉਣ ਵਾਲੇ ਦਾ ਚਾਅ ਵੀ ਭੰਗੜਾ ਦੁੱਗਣਾ ਜੋਸ਼ ਨਾਲ ਪਾਇਆ ਜਾਂਦਾ ਹੈ ਅਤੇ ਉਹਦਾ ਆਪਣਾ ਚਾਅ ਵੀ ਦੁੱਗਣਾ ਹੋ ਜਾਂਦਾ ਹੈ ਭੰਗੜਾ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦੀ ਸ਼ਾਨ ਹੈ